ਮੇਰਾ ਬ੍ਰਦਰ ਅਤੇ ਮੇਰੀ ਸਿਸਟਰ ਬਹੁਤ ਟਾਈਮ ਬਾਅਦ ਕੈਨੇਡਾ ਤੋਂ ਇੰਡੀਆ ਆਏ ਜਦੋਂ ਉਹ ਆਏ ਤਾਂ ਉਹਨਾਂ ਨੇ ਸ਼ਿਮਲਾ ਜਾਣ ਦਾ ਪਲੈਨ ਬਣਾਇਆ ਅਤੇ ਮੈਂ ਵੀ ਸ਼ਿਮਲਾ ਜਾਣਾ ਸੀ ਉਨ੍ਹਾਂ ਦੇ ਨਾਲ ਇਸ ਲਈ ਮੈਂ ਆਪਣੇ ਕੰਮ ਤੋਂ ਛੁੱਟੀਆਂ ਲਿੱਤੀਆਂ ਅਤੇ ਉਹਨਾਂ ਦੇ ਨਾਲ ਸ਼ਿਮਲਾ ਚਲੀ ਗਈ ਅਸੀਂ ਜਦੋਂ ਸ਼ਿਮਲਾ ਗਏ ਅਸੀਂ ਉੱਥੇ ਬਹੁਤ ਜ਼ਿਆਦਾ ਮਜ਼ਾ ਕੀਤਾ ਅਸੀਂ ਇੰਨੀਆਂ ਜ਼ਿਆਦਾ ਐਕਟੀਵਿਟੀਜ਼ ਕੀਤੀਆਂ ਅਸੀਂ ਬਹੁਤ ਜਗ੍ਹਾ 'ਤੇ ਘੁੰਮੇ ਅਤੇ ਆਪਣੇ ਕੰਮ ਤੋਂ ਥੋੜ੍ਹਾ ਆਰਾਮ ਲਿੱਤਾ ਜਦੋਂ ਅਸੀਂ ਉੱਥੇ ਘੁੰਮਣ ਗਏ ਤਾਂ ਅਸੀਂ ਬਹੁਤ ਥਾਵਾਂ 'ਤੇ ਗਏ ਅਤੇ ਜਿੱਥੋਂ ਮੈਨੂੰ ਬਹੁਤ ਸਾਰੀ ਨੌਲੇਜ ਵੀ ਮਿਲੀ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਅਤੇ ਇਹਦੇ ਨਾਲ ਹੀ ਮੇਰਾ ਮਾਇੰਡ ਵੀ ਪੂਰਾ ਫਰੈਸ਼ ਹੋ ਗਿਆ ਇਹ ਟਰਿੱਪ ਬਹੁਤ ਮੇਰੇ ਲਈ ਬਹੁਤ ਆਰਾਮਦਾਇਕ ਸੀ ਕਿਉਂਕਿ ਇਹਦੇ ਨਾਲ ਮੇਰਾ ਮਾਇੰਡ ਵੀ ਫਰੈਸ਼ ਹੋ ਗਿਆ ਕਿਉਂਕਿ ਆਪਾਂ ਜਦੋਂ ਡੇਲੀ ਦਾ ਕੰਮ ਕਰਦੇ ਹਾਂ ਤਾਂ ਮਾਇੰਡ ਦੇ ਵਿੱਚ ਬਰਡਨ ਪਾਈ ਜਾਂਦਾ ਹੈ ਤੇ ਜਦੋਂ ਅਸੀਂ ਜਾਂਦੇ ਆ ਕਿਤੇ ਤਾਂ ਉਹ ਬਰਡਨ ਵੀ ਘੱਟ ਜਾਂਦਾ ਹੈ ਤਾਂ ਇਹ ਟਰਿੱਪ ਮੇਰੀ ਬਹੁਤ ਜ਼ਿਆਦਾ ਆਰਾਮਦਾਇਕ ਟਰਿੱਪ ਸੀ ਜਦੋਂ ਮੈਂ ਆਪਣੇ ਭੈਣ ਅਤੇ ਭਰਾਵਾਂ ਦੇ ਨਾਲ ਸ਼ਿਮਲਾ ਗਈ